ਹੇਲੋ ਨਮਸ਼ਕਾਰ ਸਰ ਹਾਂਜੀ ਹਾਂਜੀ ਸਰ ਕੌਣ ਜੀ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਜੀ ਹਾਂਜ ਹਾਂਜੀ ਹਾਂਜੀ ਫਾਜ਼ਿਲਕਾ ਤੋਂ ਬੋਲ ਰਿਹਾ ਪੰਕਜ ਗੱਲ ਕਰ ਰਿਹਾ ਸਰ ਮੈਂ ਹਾਂਜੀ ਸਰ ਮੈਂ ਇੱਥੇ ਲੋਕਲ ਰੈਜੀਡੈਂਸ ਹੀ ਹਾਂ ਮਤਲਬ ਕ ਬਾਈ ਬਰਥ ਇੱਥੇ ਹੀ ਰਹਿ ਰਿਹਾ ਫਾਜ਼ਿਲਕਾ ਹੀ ਰਹਿ ਰਿਹਾ ਸਰ ਦੱਸੋ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਉਹ ਠੀਕ ਹੈ ਸਰ ਹਾਂਜੀ ਹਾਂਜੀ ਹਾਂਜੀ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਸਰ ਐਕਚੁਲੀ ਕੀ ਹੈ ਵੈਸੇ ਮੈਂ ਜੇਕਰ ਗੱਲ ਕਰਾਂ ਤਾਂ ਸਾਡੇ ਇੱਥੇ ਲੋਕ ਥੋੜ੍ਹੇ ਧਾਰਮਿਕ ਜ਼ਿਆਦਾ ਜਦੋਂ ਆਪਾਂ ਧਾਰਮਿਕ ਗੱਲ ਕਰ ਲੈਂਦੇ ਹਾਂ ਫਿਰ ਹਾਂਜੀ ਧਾਰਮਿਕ ਦੇ ਵਿੱਚ ਹੀ ਆਪਾਂ ਨੂੰ ਥੋੜ੍ਹਾ ਅੰਧ ਵਿਸ਼ਵਾਸ ਫਿਰ ਜ਼ਿਆਦਾ ਮਿਲਦਾ ਜਦੋਂ ਲੋਕ ਧਾਰਮਿਕ ਹੁੰਦੇ ਆ ਫਿਰ ਉਹ ਚੀਜ਼ ਅੰਧ ਅੰਧ ਵਿਸ਼ਵਾਸ ਜ਼ਿਆਦਾ ਕਰਦੇ ਜਿਵੇਂ ਮਤਲਬ ਤਿੰਨ ਜਣਿਆਂ ਨੇ ਇਕੱਠੇ ਬਾਹਰ ਨਹੀਂ ਜਾਣਾ ਜੀ ਜਿਵੇਂ ਮਤਲਬ ਇਕੱਠੇ ਜੇਕਰ ਆਪਾਂ ਕਿਸੇ ਕੰਮ 'ਤੇ ਜਾ ਰਹੇ ਹਾਂ ਤਿੰਨ ਜਣੇ ਜਾ ਰਹੇ ਹਾਂ ਤਾਂ ਉਹਨਾਂ ਨੇ ਤਿੰਨਾਂ ਨੇ ਇਕੱਠੇ ਨਹੀਂ ਜਾਣਾ ਦੋ ਜਣੇ ਪਹਿਲੇ ਜਾਣਗੇ ਇੱਕ ਜਣਾ ਬਾਅਦ ਜਾਏਗਾ ਜੇਕਰ ਆਪਾਂ ਜਿਵੇਂ ਕੁਛ ਕੋਈ ਜੇ ਮੰਨ ਕੇ ਚਲੋ ਕਿਸੇ ਕੁੜੀ ਮੁੰਡੇ ਦਾ ਰਿਸ਼ਤਾ ਹੋਇਆ ਜੀ ਠੀਕ ਹੈ ਜੇ ਮੁੰਡੇ ਵਾਲਿਆਂ ਦੇ ਘਰ ਕਿਸੇ ਨੇ ਜਾਣਾ ਕੁੜੀ ਵਾਲਿਆਂ ਨੇ ਤਾਂ ਉਹ ਮੁੰਡੇ ਵਾਲੇ ਕਹਿਣਗੇ ਤੁਸੀਂ ਤਿੰਨ ਜਣਿਆਂ ਨੇ ਨਹੀਂ ਆਉਣਾ ਤੁਸੀਂ ਚਾਰ ਜਣਿਆਂ ਨੇ ਆਉਣਾ ਜਾਂ ਦੋ ਜਣਿਆਂ ਨੇ ਆਉਣਾ ਮਤਲਬ ਇੰਨਾਂ ਕੁ ਅੰਧ ਵਿਸ਼ਵਾਸ ਹੈਗਾ ਹਾਂਜੀ ਹਾਂਜੀ ਜੇਕਰ ਤੁਹਾਨੂੰ ਛਿੱਕ ਆ ਗਈ ਹੈ ਜੇਕਰ ਤੁਸੀਂ ਆਫਿਸ ਜਾ ਰਹੇ ਹੋ ਤਾਂ ਤੁਹਾਨੂੰ ਛਿੱਕ ਆ ਗਈ ਤਾਂ ਤੁਸੀਂ ਮਤਲਬ ਪੈਰ ਝਾੜ ਕੇ ਜੁੱਤੀ ਝਾੜ ਕੇ ਦਸ ਪੰਦਰ੍ਹਾਂ ਮਿੰਟ ਬਹਿ ਕੇ ਫਿਰ ਜਾਣਾ ਅਤੇ ਹੋਰ ਮੰਨ ਕੇ ਚਲੋ ਜਿਵੇਂ ਦੁੱਧ ਪੀ ਦੁੱਧ ਪੀ ਲਿਆ ਮਿੱਠਾ ਦੁੱਧ ਪੀ ਕੇ ਬਾਹਰ ਨਹੀਂ ਜਾਣਾ ਚੌਂਕ 'ਤੇ ਨਹੀਂ ਜਾਣਾ ਅੱਜ ਤੱਕ ਮਤਲਬ ਸਾਡਾ ਹਾਂਜੀ ਹਾਂਜੀ

ਨਹੀਂ ਸਾਡੇ ਤਾਂ ਇੰਨਾ ਕੁ ਵਹਿਮ ਕਰਦੇ ਆ ਅਜੇ ਵੀ ਰਾਤੀ ਜਦੋਂ ਲੋਕ ਸੌਂਦੇ ਆ ਨਾ ਤਾਂ ਉਹ ਇਹੀ ਸੋਚ ਕੇ ਸੌਂਦੇ ਆ ਵੀ ਪਤਾ ਨਹੀਂ ਸਵੇਰੇ ਉੱਠਣਾ ਕਿ ਨਹੀਂ ਹੋਣਾ ਹਜੇ ਵੀ ਅਮਲੇ ਹਮਲੇ ਦਾ ਹਜੇ ਵੀ ਇਥੇ ਡਰ ਇੱਕ ਤਾਂ ਚਲੋ ਬਾਰਡਰ ਏਰੀਆ ਤਾਂ ਹੈਗਾ ਹੀ ਹੈਗਾ ਬਟ ਆਪਾਂ ਆਪਦੀ ਇੰਡੀਅਨ ਆਰਮੀ ਨੂੰ ਇੰਨਾਂ ਰੱਖਦੇ ਹਾਂ ਵੀ ਵੀ ਉਹ ਐਵੇਂ ਇ ਇੰਨੀ ਜਲਦੀ ਹਮਲਾ ਵਗੈਰਾ ਨਹੀਂ ਹੋਏਗਾ ਬਟ ਸਾਡੇ ਇੱਥੇ ਲੋਕ ਇੰਨਾਂ ਕੁ ਮੰਨਦੇ ਆ ਬਈ ਕਦੋਂ ਮਰਜ਼ੀ ਹਮਲਾ ਹੋ ਸਕਦਾ ਲੋਕੀ ਅ ਅੱਜ ਵੀ ਲੋਕ ਆਪਦੇ ਪੈਟਰੋਲ ਦੀਆਂ ਉਹਦੇ ਬਾਈਕਾਂ ਦੀਆ ਟੈਂਕੀਆਂ ਫੁੱਲ ਰੱਖਦੇ ਆ ਮਤਲਬ ਅੰਧ ਵਿਸ਼ਵਾਸ ਹੈਗਾ ਵੀ ਕਦੋਂ ਮਰਜ਼ੀ ਉਹ ਬਾਰਡਰ ਉਹ ਕੀ ਨਾਮ ਹੈ ਅ ਹਮਲਾ ਹੋ ਗਿਆ ਸਾਨੂੰ ਭੱਜਣਾ ਪੈ ਸਕਦਾ ਮਤਲਬ ਟੈਕਨੋਲੋਜੀ ਹਾਂਜੀ ਹਾਂਜੀ ਬਟ ਇਹ ਅੰਧ ਵਿਸ਼ਵਾਸ ਹੈ ਨਾ ਜੀ ਬਈ ਕਦੋਂ ਮਰਜ਼ੀ ਹਮਲਾ ਹੋ ਗਿਆ ਤਾਂ ਭੱਜਣਾ ਪੈ ਸਕਦਾ ਯੇ ਹੈ ਉਹ ਹੈ ਨਹੀਂ ਨਹੀਂ ਸਾਡੇ ਇਥੇ ਥੋੜਾ ਅੰਧਵਿਸ਼ਵਾਸ ਜਾਂ ਨਹੀਂ ਨਹੀਂ ਸਾਡੇ ਇੱਥੇ ਅੰਧ ਵਿਸ਼ਵਾਸ ਜ਼ਿਆਦਾ ਜੇਕਰ ਬਿੱਲੀ ਰਸਤਾ ਕੱਟ ਗਈ ਹੈ ਜੀ ਤਾਂ ਉਹ ਰਸਤੇ ਟੱਪਦੇ ਹੀ ਨਹੀਂ ਦੋ ਦੋ ਦਿਨ ਤੱਕ ਉਧਰ ਰਸਤੇ ਤੋਂ ਟਪਦਾ ਹੀ ਨਹੀਂ ਬੰਦਾ ਬੀ ਹਾਂ ਨਹੀਂ ਉਹ ਪਰਲੇ ਪਾਸੋਂ ਹੀ ਜਾਣਾ ਇੱਕ ਤਾਂ ਹੁੰਦਾ ਨਾ ਬਈ ਬਿੱਲੀ ਟੱਪ ਬਿੱਲੀ ਰਸਤਾ ਕੱਟ ਗਈ ਚਲੋ ਮਾਰੀ ਚਪਲ ਤਾਂ ਚੱਲੂ ਤਾਂ ਉਹ ਰਸਤੇ ਨੂੰ ਦੋ ਦੋ ਤਿੰਨ ਟੱਪਦੇ ਹੀ ਨਹੀਂ ਗੇ ਇੱਕ ਕੋਈ ਪਾਰਕ ਹੈ ਉਹ ਪ੍ਰਤਾਪ ਬਾਗ ਵਗੈਰਾ ਹੈਗਾ ਇੱਥੇ ਸਾਡੇ ਇੱਥੇ ਅਤੇ ਉੱਥੇ ਲੋਕਾਂ ਨੇ ਹੁਣ ਲੋਕਾਂ ਦੀਆਂ ਗੱਲਾਂ ਹੈਗੀਆਂ ਪਤਾ ਨਹੀਂ ਸੱਚ ਹੈ ਕਿ ਨਹੀਂ ਉਧਰ ਆਵਾਜ਼ਾਂ ਸੁਣੀਆਂ ਗਈਆਂ ਵੀ ਉੱਥੇ ਆਵਾਜ਼ਾਂ ਆਉਂਦੀਆਂ ਮਤਲਬ ਪਤਾ ਨਹੀਂ ਕੀ ਹੈ ਕੋਈ ਉੱਥੇ ਮਰ ਕੋਈ ਉੱਥੇ ਮਰਨ ਦੀ ਗੱਲ ਸੁਣੀ ਨਹੀਂ ਬਟ ਲੋਕ ਕਹਿੰਦੇ ਆ ਰਾਤੀ ਅੱਠ ਵਜੇ ਤੋਂ ਬਾਅਦ ਉਹ ਆਵਾਜ਼ਾਂ ਆਉਂਦੀਆਂ ਠੀਕ ਹੈ ਅਤੇ ਉੱਧਰ ਬ ਮਗਰਲੇ ਪਾਸੇ ਜਿਹੜਾ ਉਹ ਮਤਲਬ ਜੁੱਤੀਆਂ ਦਾ ਬਾਜ਼ਾਰ ਹੈ ਉੱਥੇ ਵੀ ਹੈਗਾ ਜਿਵੇਂ ਉੱਥੇ ਵੀ ਕੋਈ ਆਤਮਾ ਉਤਮਾ ਦੀ ਸ਼ੈ ਵਗੈਰਾ ਹੈਗੀ ਆ ਲੋਕ ਕਹਿੰਦੇ ਆ ਸੁਣੀਆਂ ਸੁਣਾਈਆਂ ਗੱਲਾਂ ਅੰਧ ਵਿਸ਼ਵਾਸ ਕੀ ਹੈ ਬਟ ਹੈਗੀਆਂ ਗੱਲਾਂ ਜੀ ਆਹੀ ਗੱਲਾਂ ਹੈਗੀਆਂ ਜੀ ਬਸ ਹਾਂਜੀ ਬੈਕਵਰਡ ਕਹਿ ਸਕਦੇ ਹੋ ਜੀ ਬਸ ਓਹੀ ਹੈ ਨਾ ਥੋੜ੍ਹਾ ਧਾਰਮਿਕ ਚੀਜ਼ਾਂ ਨਾਲ ਜੁੜਿਆ ਹੋਇਆ ਥੋੜ੍ਹਾ ਇੱਦਾਂ ਦਾ ਉਹ ਹੋ ਗਿਆ ਪਰਸਪੈਕਟਿਵ ਹੋ ਗਿਆ ਨਾ ਉਹ ਸਾਰੀ ਚੀਜ਼ਾਂ ਇਕੱਠੀਆਂ ਰਲ ਗਈਆਂ ਹਾਂਜੀ ਠੀਕ ਹੈ ਜੀ ਕੋਈ ਨਹੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਹਾਂਜੀ ਅਸੀਂ ਕੋਈ ਗਲਤ ਇਨਫੋਰਮੇਸ਼ਨ ਨਹੀਂ ਦਿੰਦੇ ਤੁਹਾਨੂੰ ਜਿਹੜੀ ਜੈਨੁਆਨ ਤੁਸੀਂ ਮੈਂ ਵੀ ਇੱਕ ਰਿਕਵੈਸਟ ਕਰਦਾ ਬੀ ਆਪਦੇ ਆਰਟੀਕਲ 'ਚ ਜੈਨੁਅਨ ਗੱਲਾਂ ਛਾਪੀਆਂ ਜਾਣ ਸਾਡੇ ਸ਼ਹਿਰ ਬਾਰੇ ਕੋਈ ਜ਼ਿਆਦਾ ਅਨਲਿਸਟਿਕ ਗੱਲਾਂ ਨਹੀਂ

ਠੀਕ ਹੈ ਸਰ ਠੀਕ ਹੈ ਜੀ ਓਕੇ ਸਰ ਠੀਕ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜ਼ਰੂਰ ਠੀਕ ਓਕੇ ਜੀ ਥੈਂਕ ਯੂ ਸੋ ਥੈਂਕ ਯੂ